ਹੈਲੋ ਨਮਸਕਾਰ ਜੀ ਗੱਲ ਸੁਣੋ ਮੈਂ ਗੁਰਦਾਸਪੁਰ ਦੀ ਰਹਿਣ ਵਾਲੀ ਹਾਂ ਅਸੀਂ ਇਹਨਾਂ ਪਸ਼ੂਆਂ ਦੇ ਬਾਰੇ ਗੱਲ ਕਰਦੇ ਹਾਂ ਦੇਖੋ ਅਸੀਂ ਬੱਚਾ ਖਰੀਦੀਦੇ ਹਾਂ ਪਸ਼ੂ ਖਰੀਦੀਦੇ ਨੇ ਜਦੋਂ ਆਪਾਂ ਪਸ਼ੂ ਖਰੀਦਣ ਜਾਈਦਾ ਨਾ ਆਖਿਰ ਅਸੀਂ ਆਪਣਾ ਪੈਸਾ ਲਗਾਈਦਾ ਵਾ ਪੈਸਾ ਲਗਾ ਕੇ ਅਸੀਂ ਇਹ ਸੋਚਦੇ ਹਾਂ ਕਿ ਸਾਨੂੰ ਅੱਛਾ ਜਾਨਵਰ ਮਿਲੇ ਅਗਰ ਸਾਨੂੰ ਅੱਛਾ ਜਾਨਵਰ ਮਿਲ ਜਾਂਦਾ ਵਾ ਫਿਰ ਆਪਾਂ ਉਸ ਦੀ ਉਹ ਦੇਖਦੇ ਐ ਕਿ ਸਾਨੂੰ ਇਹ ਕਿੰਨਾ ਕੁ ਦੁੱਧ ਦੇਣ ਵਾਲਾ ਜਾਨਵਰ ਹੈ ਅਤੇ ਦੁੱਧ ਦੇਗਾ ਉਹਦੇ ਹਿਸਾਬ ਨਾਲ ਆਪਾਂ ਉਹਦਾ ਦੁੱਧ ਲਗਾ ਲੈਂਦੇ ਹਾਂ ਕਿਉਂਕਿ ਅਸੀਂ ਰਕਮ ਖਰਚੀ ਹੁੰਦੀ ਆ ਅਸੀਂ ਫਿਰ ਦੁੱਧ ਵੇਚਦੇ ਹਾਂ ਵੀ ਉਹਦੀ ਕਮਾਈ ਦਾ ਸਾਧਨ ਬਣਾਉਂਦੇ ਹਾਂ ਕਿਉਂਕਿ ਇੱਕ ਕਮਾਈ ਦਾ ਸਾਧਨ ਹੈਗਾ ਵਾ ਅਗਰ ਸਾਡੇ ਅੱਛਾ ਜਾਨਵਰ ਲਵਾਂਗੇ ਅੱਛਾ ਖਰੀਦ ਉਹਦੀ ਕਰਾਂਗੇ ਅੱਛੇ ਪੈਸੇ ਦੇਵਾਂਗੇ ਅੱਛੇ ਪੈਸੇ ਕਮਾ ਸਕਦੇ ਹਾਂ ਫਿਰ ਉਸ ਤੋਂ ਬਾਅਦ ਜਾਨਵਰ ਦੀ ਇਹ ਵੀ ਸਾਨੂੰ ਪੂਰੀ ਪੂਰੀ ਉਹਦੀ ਉਹ ਕਰਨੀ ਪੈਂਦੀ ਹੈ ਦੇਖਭਾਲ ਪੂਰੀ ਪੂਰੀ ਕਰਨੀ ਪੈਂਦੀ ਹੈ ਉਹਨੂੰ ਚਾਰਾ ਟਾਈਮ ਨਾਲ ਦੇਣਾ ਪੈਂਦਾ ਹੈ ਪਾਣੀ ਪਿਲਾਉਣਾ ਪੈਂਦਾ ਹੈ ਉਹਦੀ ਸਫਾਈ ਸਾਫ ਸਫਾਈ ਉਹਨੂੰ ਰੱਖਣਾ ਪੈਂਦਾ ਹੇਠਾਂ ਅੱਜ ਕੱਲ੍ਹ ਗਰਮੀਆਂ ਮੈਂ ਗਰਮੀਆਂ ਦੇ ਵਿੱਚ ਪੱਖਿਆਂ ਦੇ ਵਿੱਚ ਸਰਦੀ ਤੋਂ ਬਚਾਉਣ ਲਈ ਉਹਨਾਂ ਨੂੰ ਉਹਨਾਂ ਦੇ ਉਹ ਬਣਾਏ ਦੇ ਆ ਉੱਤੇ ਉਹਦੇ ਵਾਲੇ ਦੁਸ਼ਾਲੇ ਜਿਹੇ ਬਣਾਈ ਦੇ ਆ ਉਹਨਾਂ ਨੂੰ ਦੇਣ ਵਾਸਤੇ ਕਿਉਂਕਿ ਉਹਨਾਂ ਨੂੰ ਨਿੱਘ ਵੀ ਲੱਗੇ ਉਹਨਾਂ ਦੀ ਪੂਰੀ ਦੇਖਭਾਲ ਸਾਨੂੰ ਕਰਨੀ ਪੈਂਦੀ ਆ ਕਿਉਂਕਿ ਪਸ਼ੂ ਦੇ ਨਾਲ ਇਨਸਾਨ ਨੂੰ ਵੀ ਪਸ਼ੂ ਹੀ ਬਣੇਗਾ ਅਤੇ ਤਾਂ ਹੀ ਪਸ਼ੂ ਦੇ ਸਾਡੇ ਕੋਲ ਅੱਛੀ ਸਾਨੂੰ ਖੁਰਾਕ ਵਗੈਰਾ ਅਸੀਂ ਉਹਨਾਂ ਨੂੰ ਅੱਛੀ ਦੇਵਾਂਗੇ ਤਾਂ ਹੀ ਉਹ ਸਾਨੂੰ ਟਰੀਟਮੈਂਟ ਸਾਡਾ ਦੁੱਧ ਵਗੈਰਾ ਸਾਨੂੰ ਵੀ ਅੱਛਾ ਦੇਣਗੇ ਨਾ ਅਗਰ ਅਸੀਂ ਉਹਦੀ ਟਰੀਟਮੈਂਟ ਸਹੀ ਕਰਦੇ ਹਾਂ ਅਗਰ ਅਸੀਂ ਸਹੀ ਨਹੀਂ ਕਰਦੇ ਉੱਦਾਂ ਹੀ ਉਹਨੂੰ ਧੁੱਪੇ ਬਿਠਾਈ ਰੱਖਾਂਗੇ ਜਾਂ ਨਾ ਕਰਾਂਗੇ ਤਾਂ ਕੋਈ ਉਹਨਾਂ ਨੇ ਸਾਨੂੰ ਤਾਂ ਕੋਈ ਬੈਨੀਫਿਟ ਹੀ ਨਹੀਂ ਦੇਣਾ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਥੋੜ੍ਹਾ ਟਾਈਮ ਡੰਗਰ ਰਿਹਾ ਵਾ ਇਸ ਤੋਂ ਬਾਅਦ ਇਹਨੂੰ ਦੇਖਿਆ ਕਿ ਸਾਡੀ ਇਹ ਤੋਂ ਕਮਾਈ ਦਾ ਸਾਧਨ ਘੱਟ ਹੈ ਫਿਰ ਅਸੀਂ ਇਹਨੂੰ ਇੱਕ ਦੂਜੇ ਤੋਂ ਦੂਜੇ ਦੂ ਦੂਸਰੇ ਬੰਦੇ ਨੂੰ ਇਹਨੂੰ ਪਰਚੇਸ ਕਰਦੇ ਨੇ ਇਹਨੂੰ ਜੋ ਕਿ ਥੋੜ੍ਹੀ ਕੀਮਤ 'ਤੇ ਅਸੀਂ ਦੇ ਦਿੰਦੇ ਹਾਂ ਫਿਰ ਅਸੀਂ ਦੂਸਰਾ ਪ ਪਸ਼ੂ ਲੈ ਆਈਦਾ ਕਿਉਂਕਿ ਇਹ ਆ ਜਿਹੜਾ ਦਿੱਤਾ ਹੋਇਆ ਗਾ ਪਸ਼ੂ ਹੈ ਕੋਈ ਤੁਹਾਨੂੰ ਭਾਵੇਂ ਥੋੜ੍ਹਾ ਹੀ ਆ ਜੇ ਅਵਾ ਕਿਉਂਕਿ ਜਿੰਨਾ ਚਿਰ ਉਹਨੇ ਦੁੱਧ ਦੇਣਾ ਜਿੱਦਾਂ ਕਿ ਅਸੀਂ ਉਹਨੂੰ ਸਾਂਭ ਸਕਦੇ ਹਾਂ ਓਨਾ ਕੁ ਹੀ ਸਾਂਭਣਾ ਹੈ ਨਾ ਉਸ ਤੋਂ ਬਾਅਦ ਆਪਾਂ ਦੇ ਦਿੰਦੇ ਹਾਂ